ਪਿੱਠ ਦਾ ਦਰਦ ਇੱਕ ਬਹੁਤ ਹੀ ਆਮ ਜਿਹਾ ਦਰਦ ਹੈ ਜੋ ਕਿਸੇ ਨੂੰ ਵੀ ਹੋ ਸਕਦਾ ਹੈ ਇਸ ਦਰਦ ਵਿੱਚ ਕੋਈ ਉਮਰ ਮਾਈਨੇ ਨਹੀਂ ਰੱਖਦੀ ਕਿਉਂਕਿ ਬਜ਼ੁਰਗਾਂ ਨੂੰ ਉਹਨਾਂ ਦੀ ਉਮਰ ਜ਼ਿਆਦਾ ਹੋਣ ਕਰਕੇ ਇਹ ਦਰਦ ਹੁੰਦਾ ਹੈ ਅਤੇ ਛੋਟੀ ਉਮਰ ਦੇ ਲੋਕਾਂ ਨੂੰ ਕਦੇ ਕਦੇ ਜ਼ਿਆਦਾ ਸਰੀਰਿਕ ਕੰਮ ਕਰਨ 'ਤੇ ਇਹ ਦਰਦ ਮਹਿਸੂਸ ਹੁੰਦਾ ਹੈ

ਜਿਸ ਨਾਲ ਉਹਨਾਂ ਨੂੰ ਇਸ ਦਰਦ ਤੋਂ ਰਾਹਤ ਮਿਲ ਜਾਂਦੀ ਹੈ ਉਹਨਾਂ ਵਿੱਚੋਂ ਇੱਕ ਇਲਾਜ ਉਹਨਾਂ ਦੇ ਆਪਦੇ ਘਰ ਦੇ ਬਣਾਏ ਕੁਝ ਤੇਲ ਹੁੰਦੇ ਹਨ ਮੇਰੇ ਪਿੰਡ ਦੇ ਲੋਕ ਉਹ ਤੇਲ ਬਣਾਉਣ ਲਈ ਕੁਝ ਜੜੀ ਬੂਟੀਆਂ ਦੀ ਵਰਤੋਂ ਕਰਦੇ ਹਨ ਉਹ ਜੜੀ ਬੂਟੀਆਂ ਦੇ ਤੇਲ ਦੀ ਦਿਨ ਵਿੱਚ ਕਈ ਵਾਰੀ ਮਾਲਿਸ਼ ਕਰਦੇ ਹਨ ਉਸ ਤੇਲ ਦੀ ਮਾਲਸ਼ ਨਾਲ ਹੀ ਬੜੇ ਲੋਕਾਂ ਨੂੰ ਬੜੀ ਜਲਦੀ ਆਰਾਮ ਆ ਜਾਂਦਾ ਹੈ ਇਸੇ ਕਰਕੇ ਹੀ ਉਹ ਇਹੋ ਜਿਹੇ ਹੋਰ ਵੀ ਕਈ ਦਰਦਾਂ ਨੂੰ ਇਸ ਤਰ੍ਹਾਂ ਦੇ ਤੇਲ ਨਾਲ ਹੀ ਸਹੀ ਕਰ ਲੈਂਦੇ ਹਨ ਇਸ ਕਰਕੇ ਉਹਨਾਂ ਲੋਕਾਂ ਦੀ ਡਾਕਟਰਾਂ ਕੋਲ ਚੱਕਰ ਬਹੁਤ ਹੀ ਘੱਟ ਲੱਗਦੇ ਹਨ ਅਤੇ ਉਹ ਡਾਕਟਰਾਂ ਤੋਂ ਬਚੇ ਵੀ ਰਹਿੰਦੇ ਹਨ